ਹਾਂਜੀ ਵੀਰੇ ਕੀ ਹਾਲ ਨੇ ਜੈਲੀ ਬੋਲਦੇ ਵੀਰੇ ਫਤਹਿਗੜ੍ਹ ਸਾਹਿਬ ਤੋਂ ਅੱਛਾ ਜੀ ਵੀਰ ਜੀ ਹੋਰ ਕੀ ਕਰਦੇ ਸੀਗੇ ਜੀ ਮੈਂ ਰਮਨ ਬੋਲਦਾ ਵੀਰੇ ਚੰਡੀਗੜ੍ਹ ਤੋਂ ਹਾਂਜੀ ਵੀਰ ਜੀ ਮੈਂ ਆਪਣੇ ਫਤਿਹਗੜ੍ਹ ਸਾਹਿਬ ਨਾ ਏਰੀਏ ਦੇ ਵਿੱਚ ਘੁੰਮਣ ਦੇ ਥਰੂ ਆਉਣਾ ਸੀਗਾ ਜੀ ਫੈਮਲੀ ਨਾਲ ਹਾਂਜੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀਗਾ ਵੀ ਤੁਸੀਂ ਆਪਣੇ ਐਧਰਲੇ ਏਰੀਏ ਦੇ ਭੇਤੀ ਹੋ ਸਾਰੇ ਵੀ ਮੈਂ ਕਿਹੜੀ ਕਿਹੜੀ ਜਗ੍ਹਾਂ ਜਾ ਸਕਦਾ ਘੁੰਮਣ ਵੀ ਕਿਹੜੀ ਕਿਹੜੀ ਵਧੀਆ ਇੱਥੇ ਮਸ਼ਹੂਰ ਜਗ੍ਹਾ ਏ ਜੀ ਅੱਛਾ ਜੀ ਹਾਂਜੀ ਹਾਂ ਜੀ ਠੀਕ ਹੈ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਅਤੇ ਉਹ ਵੀ ਚਲੋ ਠੀਕ ਹੈ ਜੀ ਅਤੇ ਗੱਡੀ ਦਾ ਵੀ ਪ੍ਰਬੰਧ ਹੋਜੂਗਾ ਜੀ ਠੀਕ ਹੈ ਹਾਂਜੀ ਫੈਮਲੀ ਨਾਲ ਆਉਣਾ ਸੀਗਾ ਚਲੋ ਇਕੱਲੇ ਦਾ ਸਰ ਜਾਂਦਾ ਤਾਂ ਫੈਮਲੀ ਨਾਲ ਆਉਣਾ ਸਾਰਾ ਅਤੇ ਬਸ ਅਤੇ ਬਾਕੀ ਫੀਸ ਵਗੈਰਾ ਕੀ ਹੈ ਜੀ ਤੁਹਾਡੀ ਮਾੜਾ ਮੋਟਾ ਦੱਸ ਦਿੰਦੇ ਜੀ

ਹਾਂਜੀ ਹਾਂਜੀ ਠੀਕ ਹੈ ਜੀ ਚਲੋ ਬਾਕੀ ਮੈਂ ਘਰੇ ਸਲਾਹ ਕਰਦਾ ਮੈਂ ਵੀਰ ਜੀ ਇੱਕ ਦੋ ਦਿਨ 'ਚ ਆਵਾਂਗਾ ਜੀ ਹਾਂਜੀ ਬਾਕੀ ਮੈਂ ਘਰੇ ਸਲਾਹ ਕਰਕੇ ਨਾ ਦੱਸਦਾ ਠੀਕ ਹੈ ਜੀ ਮੈਂ ਕਾਲ ਕਰਕੇ ਆਵਾਂਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਵੀਰੇ